ਵੈਸੇ ਤਾਂ ਮੈਂ ਸਾਰੇ ਪਕਵਾਨ ਵਧੀਆ ਬਣਾ ਲੈਂਦੀ ਹਾਂ ਜਿਵੇਂ ਕਿ ਆਲੂ ਟਿੱਕੀ ਸਮੋਸੇ ਰੋਟੀ ਸਬਜ਼ੀ ਅਤੇ ਕਈ ਹੋਰ ਪਕਵਾਨ ਜਿਵੇਂ ਕਿ ਘਰਾਂ ਦੇ ਵਿੱਚ ਚਲਦੇ ਨੇ ਅਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ਼ ਇੱਕ ਰੈਸਪੀ ਸ਼ੇਅਰ ਕਰਨਾ ਚਾਹੁੰਦੀ ਹਾਂ ਦਹੀ ਭੱਲਿਆਂ ਦੀ ਅਤੇ ਉਸ ਦੇ ਵਿੱਚ ਇੱਕ ਦ ਰਾਤ ਨੂੰ ਮਾਂਹਾਂ ਮਾਂਹਾਂ ਦੀ ਦਾਲ਼ ਅਤੇ ਥੋੜ੍ਹੀ ਜਿਹੀ ਛੋਲਿਆਂ ਦੀ ਦਾਲ਼ ਭਿਉਂ ਕੇ ਰੱਖ ਦਿਉ ਅਤੇ ਉਸ ਤੋਂ ਬਾਅਦ ਦੂਜੇ ਦਿਨ ਉਸ ਨੂੰ ਮਿਕਸੀ ਦੇ ਵਿੱਚ ਪੀਸ ਲਉ ਅਤੇ ਉਸ ਤੋਂ ਬਾਅਦ ਉਹਨੂੰ ਦਸ ਮਿੰਟ ਹਿਲਾਓ ਚੱਮਚ ਨਾਲ਼ ਜਾਂ ਫਿਰ ਕਿਸੀ ਮਧਾਣੀ ਦੇ ਨਾਲ਼ ਉਸ ਨੂੰ ਹਿਲਾਓ ਚੰਗੀ ਤਰ੍ਹਾਂ ਜਦੋਂ ਤੱਕ ਉਹ ਫੁੱਲ ਨਾ ਜਾਵੇ ਦਾਲ਼ ਅਤੇ ਦਾਲ਼ ਫੁੱਲਣ ਤੋਂ ਬਾਅਦ ਇੱਕ ਫਰਾਈਵੀਨ ਦੇ ਵਿੱਚ ਤੇਲ ਗਰਮ ਕਰੋ ਤੇਲ ਗਰਮ ਦੇ ਵਿੱਚ ਉਸ ਨੂੰ ਹੌਲ਼ੀ ਹੌਲ਼ੀ ਕਰਕੇ ਗੋਲ਼ ਗੋਲ਼ ਕਰਕੇ ਤੇਲ ਦੇ ਵਿੱਚ ਛੱਡ ਦਿਉ ਅਤੇ ਜਦੋਂ ਪੱਕ ਜਾਣਗੇ ਤਾਂ ਉਸਨੂੰ ਇੱਕ ਬਰਤਨ ਦੇ ਵਿੱਚ ਠੰਡਾ ਪਾਣੀ ਪਾ ਲਓ ਅਤੇ ਉਸ ਨੂੰ ਠੰਡੇ ਪਾਣੀ ਦੇ ਵਿੱਚ ਛੱਡ ਦਿਉ ਅਤੇ ਉਸ ਤੋਂ ਬਾਅਦ ਪਲੇਟ ਪਲੇਟ ਦੇ ਵਿੱਚ ਦਹੀਂ ਭੱਲਿਆਂ ਦੇ ਵੀ ਪਾਣੀ ਨਿਚੋੜ ਕੇ ਉਸ ਨੂੰ ਪਲੇਟ ਦੇ ਵਿੱਚ ਕੱਢ ਲਉ ਅਤੇ ਜਦੋਂ ਆਪਾਂ ਨੇ ਇੱਕ ਪਲੇਟ ਤਿਆਰ ਕਰਨੀ ਹੈ ਤਾਂ ਉਸਦੇ ਵਿੱਚ ਦੋ ਦਹੀਂ ਭੱਲੇ ਅਤੇ ਦਹੀਂ ਦੇ ਵਿੱਚ ਥੋੜ੍ਹੀ ਚੀਨੀ ਪਾ ਕੇ ਠੰਡਾ ਕਰਕੇ ਅਤੇ ਉਸਦੇ ਵਿੱਚ ਥੋੜ੍ਹੀ ਦਹੀਂ ਪਾ ਦਿਉ ਸੋਸ ਪਾ ਦਿਉ ਡ੍ਰਾਈ ਫਰੂਟਸ ਵਗੈਰਾ ਤੁਸੀਂ ਪਾ ਸਕਦੇ ਹੋ ਜਾਂ ਚੁਕੰਦਰ ਵਗੈਰਾ ਵੀ ਤੁਸੀਂ ਉੱਪਰ ਸਰਵ ਕਰ ਸਕਦੇ ਹੋ ਅਨਾਰ ਵਗੈਰਾ ਵੀ ਇਸ ਤਰ੍ਹਾਂ ਤੁਹਾਡੇ ਦਹੀਂ ਭੱਲੇ ਤਿਆਰ ਹੋ ਜਾਣਗੇ